ਸਾਡੇ ਖੇਤਰ ਵਿੱਚ ਸਰਕਾਰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਆਰਥਿਕ ਸਹਾਇਤਾ ਪ੍ਰਦਾਨ ਕਰਦੀ ਹੈ ਜਿਵੇਂ ਕਿ ਪੇਂਡੂ ਇਲਾਕੇ ਵਿੱਚ ਪਸ਼ੂ ਪਾਲਣ ਡੇਅਰੀ ਵਿਭਾਗ ਇਸਤਰੀਆਂ ਲਈ ਸਿਲਾਈ ਕਟਾਈ ਬਿਊਟੀਸ਼ਨ ਦੇ ਕੋਰਸ ਇਨ੍ਹਾਂ ਨੂੰ ਸ਼ੁਰੂ ਕਰਨ ਦੇ ਲਈ ਸਰਕਾਰ ਵੱਲੋਂ ਆਰਥਿਕ ਸਹਾਇਤਾ ਪ੍ਰਾਪਤ ਹੁੰਦੀ ਹੈ ਬਿਊਟੀਸ਼ਨ ਅਤੇ ਸਿਲਾਈ ਕਢਾਈ ਦੇ ਕੰਮ ਵਿੱਚ ਸਰਕਾਰ ਵੱਲੋਂ ਸਹਾਇਤਾ ਦੇ ਕੇ ਪਿੰਡਾਂ ਦੀਆਂ ਬਹੁਤ ਸਾਰੀਆਂ ਔਰਤਾਂ ਜੋ ਕਿ ਘਰ ਵਿੱਚ ਘਰੇਲੂ ਕੰਮ ਕਰਦੀਆਂ ਹਨ ਉਨ੍ਹਾਂ ਨੂੰ ਆਪਣਾ ਰੋਜ਼ਗਾਰ ਤੋਰਨ ਲਈ ਇੱਕ ਵਧੀਆ ਮੌਕਾ ਦਿੱਤਾ ਜਾਂਦਾ ਹੈ ਪਿੰਡਾਂ ਦੇ ਵਿੱਚ ਜ਼ਿਆਦਾਤਰ ਪਸ਼ੂ ਹੋਣ ਦੇ ਕਾਰਨ ਪਸ਼ੂ ਵਿਭਾਗ ਪਸ਼ੂ ਪਾਲਣ ਡੇਅਰੀ ਵਿਭਾਗ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਲੋਕ ਆਪਣਾ ਕਾਰੋਬਾਰ ਤੋਰ ਕੇ ਵਧੀਆ ਆਮਦਨ ਕਮਾ ਸਕਦੇ ਹਨ